ਅਸੀਂ ਪਰਚੂਨ ਜਾਂ ਥੋਕ ਬਜ਼ਾਰ ਦਾ ਸਮਾਨ ਵੀ ਆਰ ਮੋਲ ਦੇ ਵਿੱਚੋਂ ਹੀ ਲੈਣ ਜਾਂਦੇ ਹਾਂ ਅਤੇ ਅੱਜ ਕੱਲ ਜੋ ਕਰਿਆਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਬਹੁਤ ਵੱਡੀ ਬੜਤ ਹੋਈ ਹੈ ਇਸਦੇ ਕੀ ਕਾਰਨ ਹਨ ਅਤੇ ਅਸੀਂ ਜਦੋਂ ਔਨਲਾਈਨ ਕੋਈ ਵੀ ਖਰੀਦ ਅ ਮੰਗਵਾਉਂਦੇ ਹਾਂ ਜਾਂ ਖਰੀਦਦਾਰੀ ਕਰਦੇ ਹਾਂ ਉਹ ਚੰਗੇ ਮਾੜੇ ਪ੍ਰੋਡਕਟ ਨਿਕਲ ਹੀ ਆਉਂਦੇ ਆ ਇਸ ਕਰਕੇ ਔਨਲਾਈਨ ਬਹੁਤ ਘੱਟ ਅਸੀਂ ਖਰੀਦਦਾਰੀ ਕਰਦੇ ਹਾਂ ਅਤੇ ਜਾ ਕੇ ਅਸੀਂ ਪਰਚੂਨ ਜਾਂ ਥੋਕ ਬਾਜ਼ਾਰ ਜਾਂ ਕਿਸੇ ਦੁਕਾਨ ਤੋਂ ਜਾ ਕੇ ਅਸੀਂ ਸਮਾਨ ਲੈ ਕੇ ਆ ਜਾਂਦੇ ਹਾਂ